ਹਾਂਜੀ ਸਰ ਗੁਡ ਆਫਟਰਨੂਨ ਐਮ ਜੈਸਮੀਨ ਐਮ ਅ ਫੂਡ ਵਲੋਗਰ ਅਤੇ ਮੈਂ ਫੂਡ ਵਲੋਗਿੰਗ ਦੇ ਰਿਲੇਟਿਡ ਤੁਹਾਨੂੰ ਪੁੱਛਣਾ ਸੀਗਾ ਕਿ ਪਹਿਲੀ ਗੱਲ ਤਾਂ ਇਹ ਤੁਸੀਂ ਹੁਸ਼ਿਆਰਪੁਰ ਤੋਂ ਹੀ ਬੋਲਦੇ ਹੋ ਤੁਸੀਂ ਮੈਨੂੰ ਕੁਛ ਮਤਲਬ ਕਿ ਮੇਰੇ ਵਲੋਗ ਨੂੰ ਦੇ ਲਈ ਕੁਛ ਮੈਨੂੰ ਸੁਜੈਸ਼ਨਸ ਦੱਸ ਸਕਦੇ ਹੋ ਮਤਲਬ ਕਿ ਜਿਹਨਾਂ ਨੂੰ ਹੁਸ਼ਿਆਰਪੁਰ ਆਵਾਂ ਕਿ ਤੁਸੀਂ ਕੀ ਕੀ ਮੈਨੂੰ ਕਿਹੜੀ ਕਿਹੜੀ ਜਗ੍ਹਾ ਜਾਣਾ ਚਾਹੀਦਾ ਅਤੇ ਕਿਹੜੀ ਵਧੀਆ ਹੈ ਕਿਹੜੀ ਬੈਸਟ ਹੈ ਅਤੇ ਕਿੱਥੇ ਨਾ ਟ੍ਰਾਈ ਕਰ ਕੀਤਾ ਜਾਵੇ ਥੋੜ੍ਹਾ ਆਪਣਾ ਵਿਊ ਦੱਸ ਸਕਦੇ ਹੋ ਠੀਕ ਹੈ ਹੁੰ ਅੱਛਾ ਜੇ ਮੈਂ ਕੋਈ ਮਤਲਬ ਬਰਗਰ ਕੋਈ ਟਰਾਈ ਕਰਨਾ ਹੋਵੇ ਤਾਂ ਮੈਂ ਕਿੱਥੇ ਦਾ ਮਤਲਬ ਕਿ ਚੂਜ ਕਰਾਂ

ਮਤਲਬ ਅਤੇ ਹੋਰ ਕੋਈ ਬਲਕਿ ਜਿਵੇਂਕਿ ਆਪਣੇ ਹੋ ਗਏ ਕੋਈ ਹੋਰ ਡਿਸ਼ ਟ੍ਰਾਈ ਕਰਨੀ ਹੋਵੇ ਜਿਵੇਂ ਪਨੀਰ ਟਿੱਕਾ ਕੋਈ ਮਸ਼ਰੂਮ ਟਿੱਕਾ ਇਹੋ ਜਿਹੀ ਜਿੱਦਾਂ ਚਾਪ ਲਾਈਕ ਸੋਯਾ ਚਾਪ ਕਿੱਥੋਂ ਮੈ ਕੀ ਤੁਹਾਨੂੰ ਲੱਗਦਾ ਕੀ ਖਾਣਾ ਚਾਹੀਦਾ ਹੈ ਲਾਈਕ ਹੈਲਦੀ ਚੀਜ਼ਾਂ ਯੂਜ਼ ਕਰਨ ਵਿੱਚ ਉਹ ਜਿਹੜੀਆਂ ਹੋਰ ਕੋਈ ਸੁਜੈਸ਼ਨ ਤੁਹਾਡੀ

ਠੀਕ ਹੈ ਠੀਕ ਹੈ ਜੇ ਹੁਣ ਗੱਲ ਕੀਤੀ ਜਾਵੇ ਤਾਂ ਅਸੀਂ ਹਾਈਜੀਨਿਕ ਅਗਰ ਆਪਾਂ ਗੱਲ ਕਰੀਏ ਅਨਹਾਈਜੀਨ ਜਿੱਥੇ ਤੁਸੀਂ ਕਹੋਗੇ ਕਿ ਇੱਥੇ ਬਿਲਕੁਲ ਵੀ ਨਾ ਜਾਇਓ ਤੁਹਾਡੇ ਅਕੋਰਡਿੰਗ ਹੁਸ਼ਿਆਰਪੁਰ 'ਚ ਕਿਹੜੀ ਜਗ੍ਹਾ ਜਿੱਥੇ ਤੁਸੀਂ ਕਹੋਗੇ ਕਿ ਦੋ ਨੋਟ ਟਰਾਈ ਦਿਸ

ਅਤੇ ਹੋਰ ਮਤਲਬ ਕਿ ਤੁਹਾਨੂੰ ਸਭ ਤੋਂ ਅਗਰ ਪਿਜੇਰੀਆ ਦੀ ਗੱਲ ਕਰੀਏ ਤਾਂ ਮਤਲਬ ਕਿਹੜਾ ਕੈਫੇ ਮਤਲਬ ਕਿ ਵਧੀਆ ਇੱਥੇ ਹੈਗਾ ਹੁਸ਼ਿਆਰਪੁਰ 'ਚ ਆਪਣੇ ਜੇ ਆਪਾਂ ਪੀਜ਼ਾ ਖਾਣਾ ਹੋਵੇ ਜਾਂ ਲਾਈਕ ਰੈਸਟੋਰੈਂਟ ਲਾਈਕ ਆਪਾਂ ਫੂਡ ਖਾਣਾ ਹੋਵੇ ਹੋਰ ਸਰ ਹੋਰ ਕੋਈ ਸੁਜੈਸ਼ਨ ਓਕੇ ਸਰ ਥੈਂਕ ਯੂ ਫੋਰ ਗਿਵਿੰਗ ਅਸ ਟਾਈਮ